ਹੈਲੋ ਹਾਂਜੀ ਅਭੀ ਮੋਬਾਈਲ ਸ਼ੋਪ ਤੋਂ ਬੋਲ ਰਹੇ ਹਾਂਜੀ ਉਹ ਮੈਂ ਤੁਹਾਡੀ ਸ਼ੋਪ ਤੋਂ ਫ਼ੋਨ ਔਡਰ ਕੀਤਾ ਸੀਗਾ ਵੀਵੋ ਵਾਈ ਇੱਕੀ ਮੋਡਲ ਹਾਂਜੀ ਉਹ ਮੈਨੂੰ ਮਿਲ ਗਿਆ ਤੁਹਾਡਾ ਬੰਦਾ ਆਇਆ ਸੀਗਾ ਦੇਣ ਹਾਂਜੀ ਉਹਦਾ ਬਸ ਨੇਚਰ ਬਹੁਤ ਵਧੀਆ ਸੀਗਾ ਉਹਦੀ ਬੋਲਬਾਣੀ ਵਧੀਆ ਸੀਗੀ ਮੈਨੂੰ ਉਹ ਫ਼ੋਨ ਦੇ ਕੇ ਗਿਆ ਅਤੇ ਮੈਨੂੰ ਜਦੋਂ ਮੈਂ ਫ਼ੋਨ ਖੋਲ੍ਹਿਆ ਤਾਂ ਉਹਦੀ ਆਊਟਲੁੱਕ ਏ ਬਹੁਤ ਵਧੀਆ ਸੀਗੀ ਜਦੋਂ ਮੈਂ ਉਹਨੂੰ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਗਲਾਸ ਗਾਰਡ ਪਵਾਇਆ ਹੋਇਆ ਸੀਗਾ ਨਾਲ਼ ਬੈਕ ਕਵਰ ਵੀ ਸੀਗਾ ਉਹਦੇ ਲਈ ਧੰਨਵਾਦ ਤੁਸੀਂ ਬੈਕ ਕਵਰ ਨਾਲ਼ ਦਿੱਤਾ ਮੈਂ ਉਹਦੇ ਫੀਚਰ ਵਗੈਰਾ ਦੇਖੇ ਜਦੋਂ ਉਹਦੀ ਬੈਟਰੀ ਦੀ ਬੈਕਅੱਪ ਦੀ ਕਾਫ਼ੀ ਵਧੀਆ ਆ ਅਤੇ ਕੈਮਰਾ ਦੀ ਕੁਆਲਿਟੀ ਵੀ ਬਹੁਤ ਅੱਛੀ ਆ ਹਾਂਜੀ ਮੈਂ ਚਾਹੁੰਦਾ ਹਾਂ ਕਿ ਇੱਦਾਂ ਦਾ ਕੋਈ ਫ਼ੋਨ ਹੋਰ ਹੋਵੇ ਤਾਂ ਮੈਂ ਉਹ ਲੈਣਾ ਚਾਹੁੰਦਾ ਹਾਂ ਜੇ ਕੋਈ ਹੋਰ ਹੋਏ ਤਾਂ ਜ਼ਰੂਰ ਦੱਸਣਾ ਮੈਨੂੰ ਇੱਕ ਹੋਰ ਫ਼ੋਨ ਉਹਦੇ ਨਾਲ਼ ਦਾ ਚਾਹੀਦਾ ਹੈ ਆ ਹਾਂ ਹੈੱਡਫੋਨ ਹਾਂ ਹੈੱਡਫੋਨ ਵੀ ਬਹੁਤ ਵਧੀਆ ਸੀਗੇ ਉਹਦੇ ਹਾਂ ਸਮੂਥ ਆ ਨਾਲ਼ੇ ਕੋਈ ਹੈਂਗ ਵਗੈਰਾ ਨਹੀਂ ਕਰਦਾ ਮੇਰੇ ਕੋਲ ਪਹਿਲਾਂ ਇੱਕ ਫ਼ੋਨ ਸੀਗਾ ਉਹ ਹੈਂਗ ਕਰਦਾ ਸੀਗਾ ਇਹ ਤਾਂ ਬਹੁਤ ਵਧੀਆ ਚੱਲ ਰਿਹਾ ਹਾਂਜੀ ਹਾਂ ਮੈਨੂੰ ਤੁਹਾਡੇ ਨਾਲ਼ ਗੱਲ ਕਰਕੇ ਬਹੁਤ ਵਧੀਆ ਲੱਗਾ ਕਿਰਪਾ ਕਰਕੇ ਜੇ ਕੋਈ ਹੋਰ ਫ਼ੋਨ ਹੋਇਆ ਤਾਂ ਜ਼ਰੂਰ ਭੇਜਣਾ ਧੰਨਵਾਦ